ਕਾਨੂੰਨੀ ਪ੍ਰਣਾਲੀ ਇੱਕ ਮਹੱਤਵਪੂਰਨ ਸ਼ੈ ਜੋ ਸਮਾਜ ਦੀ ਸੁਰਕਸ਼ਾ ਅਤੇ ਵਿਕਾਸ ਲਈ ਜ਼ਰੂਰੀ ਹੈ ਇਸ ਦੇ ਨਾਲ ਇਸ ਨੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਕਿ ਸਮਾਜ ਵਿੱਚ ਜੇ ਕੁਛ ਗਲਤ ਕੰਮ ਹੁੰਦਾ ਉਹਦੇ ਵਾਸਤੇ ਕਾਨੂੰਨ ਬਣਾਏ ਗਏ ਹਨ ਬਈ ਜੇ ਕੋਈ ਕੁਝ ਗਲਤ ਕਰਦਾ ਹੈਗਾ ਤਾਂ ਉਹਨੂੰ ਉਹਦੀ ਸਜ਼ਾ ਮਿਲਦੀ ਹੈ ਤਾਂ ਐ ਕਾਨੂੰਨ ਕਾਨੂੰਨ ਦਾ ਹੀ ਲੋਕਾਂ ਵਿੱਚ ਇਹ ਡਰ ਹੁੰਦਾ ਹੈ ਕਿ ਅਸੀਂ ਕੋਈ ਗਲਤ ਕੰਮ ਨਾ ਕਰੀਏ ਜੇ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਸਜ਼ਾ ਮਿਲਣੀ ਹੈਗੀ ਹੈ ਕਾਨੂੰਨ ਅਹ ਆਪਣੇ ਦੇਸ਼ 'ਚ ਬਹੁਤ ਜ਼ਰੂਰੀ ਹੈਗਾ ਕਾਨੂੰਨ ਨਾ ਹੋਵੇ ਤਾਂ ਦੇਸ਼ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀ ਫੈਲ ਜਾਵੇ ਆਤੰਕਵਾਦ ਫੈਲ ਜਾਵੇ ਬਹੁਤ ਕੁਛ ਮਤਲਬ ਗਲਤ ਹੋਊਗਾ ਜੇ ਕਾਨੂੰਨ ਹੈਗਾ ਤਾਂ ਤਾਂ ਲੋਕਾਂ ਨੂੰ ਵੀ ਵਿਸ਼ਵਾਸ ਹੈਗਾ ਕਿ ਦੇਸ਼ ਵਿੱਚ ਸੁਰਕਸ਼ਾ ਹੈਗੀ ਹੈ ਅ ਕਾਨੂੰਨ ਰਾਹੀਂ ਜੇ ਕੋਈ ਗਲਤ ਕੰਮ ਕਰਦਾ ਹੈ ਤਾਂ ਉਹਨੂੰ ਮਤਲਬ ਵੈਲ ਵੈਸੇ ਤਾਂ ਕੋਈ ਬਹੁਤ ਅਹ ਘੱਟ ਗਲਤ ਕਰਦਾ ਪਰ ਜੇ ਕੋਈ ਕਰਦਾ ਤਾਂ ਉਹਨੂੰ ਪਤਾ ਹੈ ਕਿ ਮੈਨੂੰ ਵੀ ਕਾਨੂੰਨ ਰਾਹੀਂ ਮੈਨੂੰ ਸਜਾ ਮਿਲ ਜਾਵੇਗੀ ਅਤੇ ਲੋਕਾਂ ਨੂੰ ਕਾਨੂੰਨ 'ਤੇ ਬਹੁਤ ਵਿਸ਼ਵਾਸ ਹੈਗਾ ਕਿ ਲੋਕਾਂ ਨੂੰ ਕਾ ਅ ਕਾਨੂੰਨ 'ਤੇ ਅੰਧ ਵਿਸ਼ਵਾਸ ਹੈਗਾ ਵੀ ਜ